ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਮਹੱਤਤਾ ਹੈ ਭੰਗੜਾ ਪੰਜਾਬੀਆਂ ਦਾ ਪ੍ਰਸਿੱਧ ਨਾਚ ਹੈ ਇਹ ਨਾਚ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਇਹ ਨਾਚ ਦਾ ਸੰਬੰਧ ਵਿਸਾਖੀ ਦੇ ਮੇਲੇ ਦੇ ਨਾਲ ਹੈ ਲੋਹੜੀ ਦੇ ਤਿਉਹਾਰ 'ਤੇ ਵੀ ਭੰਗੜਾ ਪਾਇਆ ਜਾਂਦਾ ਹੈ ਪਹਿਲਾਂ ਭੰਗੜਾ ਕੇਵਲ ਪੰਜਾਬ ਦਾ ਹੀ ਨਾਚ ਸੀ ਪਰ ਹੁਣ ਇਹ ਅੰਤਰਰਾਸ਼ਟਰੀ ਸਤਰ 'ਤੇ ਵੀ ਕੀਤਾ ਜਾਂਦਾ ਹੈ